ਪੰਜ ਮਈ ਦੋ ਹਜ਼ਾਰ ਇੱਕ ਸੋਲ੍ਹਾਂ ਜਨ ਜੂਨ ਉੱਨੀ ਸੌ ਤਰਾਨਵੇਂ ਅੱਠ ਮਾਰਚ ਦੋ ਹਜ਼ਾਰ ਪੰਦਰ੍ਹਾਂ ਪੱਚੀ ਜੁਲਾਈ ਦੋ ਹਜ਼ਾਰ ਇੱਕੀ ਉਨੱਤੀ ਫਰਵਰੀ ਦੋ ਹਜ਼ਾਰ ਬਾਈ